ਸਤਿ ਸ਼੍ਰੀ ਅਕਾਲ ਜੀ ਸਾਨੂੰ ਡਾਂਸ ਪੰਜਾਬੀ ਡਾਂਸ ਪਸੰਦ ਹੈ ਸਾਨੂੰ ਵੈਸਟਰਨ ਡਾਂਸ ਨਹੀਂ ਪਸੰਦ ਪੰਜਾਬੀ ਡਾਂਸ ਇਸ ਕਰਕੇ ਪਸੰਦ ਹੈ ਕਿਉੰਕਿ ਉਹਦੇ ਵਿੱਚ ਫੁੱਲ ਪਹਿਰਾਵਾ ਹੁੰਦਾ ਅਤੇ ਉਹ ਸਾਡੇ ਸੱਭਿਆਚਾਰ ਨਾਲ ਜੁੜਿਆ ਹੁੰਦਾ ਹੈ ਇਸ ਕਰਕੇ ਸਾਨੂੰ ਪੰਜਾਬੀ ਡਾਂਸ ਹੀ ਪਸੰਦ ਹੈ ਵੈਸਟਰਨ ਡਾਂਸ ਦੇ ਵਿੱਚ ਮਤਲਬ ਕਿ ਜ਼ਿਆਦਾਤਰ ਅੰਗਹੀਣਤਾ ਦਿਖਾਈਆਂ ਜਾਂਦੀਆਂ ਅਸ਼ਲੀਲ ਦਿਖਾਈਆਂ ਜਾਂਦੀਆਂ ਹਨ ਇਸ ਕਰਕੇ ਸਾਨੂੰ ਪੰਜਾਬੀ ਡਾਂਸ ਬਹੁਤ ਜ਼ਿਆਦਾ ਪਸੰਦ ਹੈ ਪੰਜਾਬੀ ਡਾਂਸ ਦੇ ਵਿੱਚ ਪ੍ਰੋਪਰ ਪੰਜਾਬੀ ਪਹਿਰਾਵਾ ਹੁੰਦਾ ਮਤਲਬ ਕਿ ਉਹ ਸਾਡੇ ਸੱਭਿਆਚਾਰ ਰਿ ਦੇ ਸੱਭਿਆਚਾਰਕ ਨਾਲ ਸੰਬੰਧ ਰੱਖਦਾ ਹੈ ਅਤੇ ਸਾਨੂੰ ਪੰਜਾਬੀ ਭੰਗੜਾ ਪੰਜਾਬੀ ਗਿੱਧਾ ਪੰਜਾਬੀ ਐਦਾਂ ਦੇ ਸਭ ਕੁਛ ਪੰਜਾਬੀ ਹੀ ਪਸੰਦ ਹੈ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਇਸ ਕਰਕੇ ਸਾਨੂੰ ਪੰਜਾਬ ਦਾ ਸਭ ਕੁਛ ਪੰਜਾਬੀ ਗਿੱਧਾ ਪੰਜਾਬੀ ਭੰਗੜਾ ਅਤੇ ਇਸ ਕਰਕੇ ਸਾਨੂੰ ਪੰਜਾਬੀ ਡਾਂਸ ਹੀ ਪਸੰਦ ਹੈ ਡਾਂਸ ਮਤਲਬ ਕਿ ਵੈਸਟਰਨ ਡਾਂਸ ਅਤੇ ਦੁ ਵੈਸਟਰਨ ਡਾਂਸ ਬਹੁਤ ਗਲਤ ਹੁੰਦਾ ਹੈ ਜੋ ਕਿ ਸਾਨੂੰ ਅਸ਼ਲੀਲਤਾ ਦੀ ਤਰਫ ਲਿਜਾਂਦਾ ਹੈ ਉਸ ਨਾਲ ਸਾਡੇ 'ਤੇ ਪ੍ਰਭਾਵ ਵੀ ਬਹੁਤ ਜ਼ਿਆਦਾ ਪੈਂਦਾ ਹੈ ਗਲਤ ਪ੍ਰਦਾਵ ਪ੍ਰਭਾਵ ਵੀ ਪੈਂਦਾ ਹੈ ਇਸ ਕਰਕੇ ਸਾਨੂੰ ਪੰਜਾਬੀ ਡਾਂਸ ਹੀ ਪਸੰਦ ਹੈ ਪੰਜਾਬੀ ਡਾਂਸ ਦੇ ਵਿੱਚ ਫੁੱਲ ਕਵਰਿੰਗ ਕੱਪੜੇ ਪਾਏ ਜਾਂਦੇ ਨੇ ਜੋ ਕਿ ਪੰਜਾਬੀ ਡਾਂਸ ਆਪਾਂ ਨੂੰ ਕੁਛ ਸਮਝਾਉਂਦਾ ਵੀ ਹੈ ਅਤੇ ਵੈਸਟਰਨ ਡਾਂਸ ਨਾਲ ਦੇਖ ਕੇ ਸਾਡੇ ਬੱਚਿਆਂ 'ਤੇ ਪ੍ਰਭਾਵ ਵੀ ਪੈਂਦਾ ਹੈ ਸਾਡੇ ਲੋਕ ਸਾਨੂੰ ਗਲਤ ਦਿਸ਼ਾ ਵੱਲ ਵੀ ਲੈ ਕੇ ਜਾਂਦਾ ਇਸ ਕਰਕੇ ਸਾਨੂੰ ਪੰਜਾਬੀ ਡਾਂਸ ਹੀ ਜ਼ਿਆਦਾਤਰ ਪਸੰਦ ਹੈ ਅਤੇ ਪੰਜਾਬੀ ਡਾਂਸ ਹੀ ਜ਼ਿਆਦਾ ਅਸੀਂ ਪਸੰਦ ਕਰਦੇ ਹਾਂ ਥੈਂਕ ਯੂ